ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਸੁਰਜੀਤ ਕੁਮਾਰ ਪਠਾਨਕੋਟ ਤੋਂ ਬੋਲਦਾ ਹਾਂ ਜਿਵੇਂ ਤੁਸੀਂ ਦੱਸਿਆ ਹੈ ਕਿ ਤੁਹਾਡੇ ਆਲੇ ਦੁਆਲੇ ਪਾਣੀ ਦੀ ਕਮੀ ਹੋ ਸਕਦੀ ਹੈ ਅਤੇ ਉਪਾਅ ਕਰਦੇ ਹੋ ਸਾਡੇ ਪਿੰਡ ਵਿੱਚ ਤਾਂ ਪਹਿਲਾਂ ਪਾਣੀ ਦੀ ਬਹੁਤ ਹੀ ਕਮੀ ਸੀ ਸਾਡੇ ਪਿੰਡ ਵਿੱਚ ਪਹਿਲਾਂ ਤਾਂ ਦੂਰ ਦੂਜੇ ਪਿੰਡ ਵਿੱਚ ਇੱਕ ਕੂਆ ਸੀ ਜਿੱਥੋਂ ਸਾਰੇ ਲੋਕ ਪਾਣੀ ਭਰਦੇ ਸੀ ਪੂਰਾ ਪਿੰਡ ਪਾਣੀ ਭਰਦਾ ਹੈ ਸੀ ਲੇਕਿਨ ਅੱਜ ਦੀ ਡੇਟ ਵਿੱਚ ਅੱਜ ਦੀ ਡੇਟ ਵਿੱਚ ਸਾਡੇ ਪਿੰਡ ਵਿੱਚ ਪਾਣੀ ਦੀ ਬਹੁਤ ਹੀ ਵਿਵਸਥਾ ਹੈ ਹੁਣ ਤਾਂ ਹਰ ਘਰ ਵਿੱਚ ਨਲਕਾ ਲੱਗਿਆ ਹੋਇਆ ਹੈ ਜਿੱਦਾਂ ਕਿ ਵਾਟਰ ਸਪਲਾਈ ਦਾ ਨਲਕਾ ਕੁਝ ਲੋਕਾਂ ਦੇ ਘਰ ਤਾਂ ਆਪਣਾ ਖੁਦ ਦਾ ਬੋਰ ਵੀ ਹੈ ਲੇਕਿਨ ਹੁਣ ਤਾਂ ਸਾਡੇ ਪਿੰਡ ਵਿੱਚ ਬਹੁਤ ਹੀ ਮਜ਼ਾ ਹੈ ਮਜ਼ਾ ਇਸ ਲਈ ਕਿ ਜਿਹਨਾਂ ਦੇ ਘਰ ਪਾਣੀ ਦਾ ਪ੍ਰਬੰਧ ਨਹੀਂ ਸੀ ਉਹਨਾਂ ਦੇ ਘਰ ਵੀ ਪਾਣੀ ਆ ਗਿਆ ਹੈ ਇਸ ਲਈ ਸਾਡੇ ਪਿੰਡ ਵਿੱਚ ਪਾਣੀ ਦੀ ਸਮੱਸਿਆ ਦਾ ਹੱਲ ਹੋ ਚੁੱਕਿਆ ਹੈ ਸਾਡੇ ਪਿੰਡ ਵਿੱਚ ਹਰ ਘਰ ਵਿੱਚ ਵਾਟਰ ਸਪਲਾਈ ਦਾ ਨਲਕਾ ਲੱਗਿਆ ਹੋਇਆ ਹੈ